ਸਾਡੀ ਪੰਜਾਬੀ ਭਾਸ਼ਾ ਇੱਕ ਬਹੁਤ ਹੀ ਚੰਗੀ ਭਾਸ਼ਾ ਹੈ ਅਤੇ ਪੰਜਾਬੀ ਭਾਸ਼ਾ ਪੂਰੇ ਦੇਸ਼ ਵਿਦੇਸ਼ ਵਿੱਚ ਬੋਲੀ ਜਾਂਦੀ ਹੈ ਅਤੇ ਪੰਜਾਬੀ ਭਾਸ਼ਾ ਵਿੱਚ ਲਿਖੇ ਗਏ ਗੀਤ ਅਤੇ ਅਤੇ ਪੂਰੇ ਕੰਨਿਆ ਕੁਮਾਰੀ ਤੱਕ ਸੁਣੇ ਜਾਂਦੇ ਹਨ ਅਤੇ ਪੰਜਾਬੀ ਸਾਨੂੰ ਹਰੇਕ ਕਿਤੇ ਟੱਕਰ ਜਾਂਦੇ ਹਨ ਭਾਵੇਂ ਕੋਈ ਵੀ ਦੇਸ਼ ਜਾਂ ਵਿਦੇਸ਼ ਹੋਵੇ ਪੰਜਾਬੀ ਬੋਲਣ ਵਾਲੇ ਸਾਨੂੰ ਹਰੇਕ ਕਿਤੇ ਮਿਲ ਜਾਣਗੇ ਅਤੇ ਜੋ ਵੀ ਪੰਜਾਬ ਦਾ ਵਿਰਸਾ ਹੈ ਉਹ ਵੀ ਪੰਜਾਬੀ ਵਿੱਚ ਬੋਲਿਆ ਜਾਂਦਾ ਹੈ ਅਤੇ ਜੋ ਵੀ ਸਾਡੇ ਗੁਰੂ ਸਾਹਿਬਾਨ ਨੇ ਬਾਣੀ ਲਿਖੀ ਹੋਈ ਹੈ ਉਹ ਵੀ ਪੰਜਾਬੀ ਵਿੱਚ ਲਿਖੀ ਹੋਈ ਹੈ ਅਤੇ ਸਾਡੇ ਗੁਰੂ ਸਾਹਿਬਾਨ ਦੀ ਬੋਲੀ ਵੀ ਪੰਜਾਬੀ ਹੈ ਅਤੇ ਜੋ ਕਿ ਸਾਡੇ ਲਈ ਬਹੁਤ ਇੱਕ ਬਹੁਤ ਵੱਡੀ ਗੱਲ ਹੈ ਕਿ ਸਾਡੇ ਇੰਨੇ ਵੱਡੇ ਵੱਡੇ ਗੁਰੂ ਵੀ ਪੰਜਾਬੀ ਬੋਲਦੇ ਸਨ ਅਤੇ ਅਤੇ ਸਾਡੇ ਬੱਚਿਆਂ ਨੂੰ ਵੀ ਸਾਨੂੰ ਪੰਜਾਬੀ ਸਿਖਾਉਣੀ ਚਾਹੀਦੀ ਹੈ ਅਤੇ ਪੜ੍ਹਾਉਣੀ ਚਾ ਚਾਹੀਦੀ ਹੈ ਪੰਜਾਬੀ ਦੀ ਦੀ ਇੱਕ ਬਹੁਤ ਚੰਗੀਆਂ ਗੱਲਾਂ ਹਨ ਕਿ ਜੇ ਉਹ ਪੰਜਾਬੀ ਸਿੱਖਣਗੇ ਤਾਂ ਉਹਨਾਂ ਨੂੰ ਚੰਗੇ ਵਿਚਾਰ ਆਉਣਗੇ ਅਤੇ ਉਹਨਾਂ ਦੀ ਬਹੁਤ ਪ੍ਰਸ਼ੰਸਾ ਹੋਊਗੀ ਪੰਜਾਬੀ ਦੇ ਵਿਚਾਰ ਬਹੁਤ ਚੰਗੇ ਹਨ ਅਤੇ ਬੋਲਣ ਵਿੱਚ ਵੀ ਅਤੇ ਸੁਣਨ ਵਿੱਚ ਵੀ ਅਤੇ ਬੱਚਿਆਂ ਨੂੰ ਇਨ੍ਹ ਪੰਜਾਬੀ ਨੂੰ ਮੂਹਰੇ ਰੱਖ ਕੇ ਚੱਲਣਾ ਚਾਹੀਦਾ ਹੈ ਅਤੇ ਉਹ ਹੋਰ ਭਾਸ਼ਾਵਾਂ ਨੂੰ ਮੂਹਰੇ ਰੱਖਦੇ ਹਨ ਅਤੇ ਪੰਜਾਬੀ ਨੂੰ ਵੀ ਉਹਨਾਂ ਨੂੰ ਉਨ੍ਹਾਂ ਹੀ ਮਹੱਤਵਪੂਰਨ ਸਮਝਣਾ ਚਾਹੀਦਾ ਜਿੰਨੀਆਂ ਹੋਰ ਭਾਸ਼ਾਵਾਂ ਨੂੰ ਸਮਝਦੇ ਹਨ ਅਤੇ ਪੰਜਾਬੀ ਵਿੱਚ ਬੋਲਣਾ ਇੱਕ ਬਹੁਤ ਚੰਗੀ ਗੱਲ ਹੈ ਅਤੇ ਪੰਜਾਬੀ ਸੁਣਨਾ ਵੀ ਅਤੇ ਪੰ ਪੰਜਾਬੀ ਇੱਕ ਐਹ ਐਹ ਜਿਹੀ ਭਾਸ਼ਾ ਹੈ ਜੋ ਕਿ ਸਿਰਫ਼ ਪੰਜਾਬ ਵਿੱਚ ਹੀ ਨਹੀਂ ਹਰੇਕ ਕਿਤੇ ਬੋਲੀ ਜਾਂਦੀ ਹੈ ਅਤੇ ਹਰੇਕ ਕਿਤੇ ਸੁਣੀ ਜਾਂਦੀ ਹੈ ਅਤੇ ਇਸ ਕਰਕੇ ਸਾਨੂੰ ਸਾਰੇ ਬੱਚਿਆਂ ਨੂੰ ਪੰਜਾਬੀ ਸਿੱਖਣੀ ਚਾਹੀਦੀ ਹੈ